ਮੈਂ ਕਿਸੇ ਵੀ ਖੇਡ ਵਿੱਚ ਨਿਵੇਸ਼ ਨਹੀਂ ਕੀਤਾ ਲੇਕਿਨ ਮੈਂ ਭਾਗ ਲੈਂਦਾ ਰਿਹਾ ਸਾਢੇ ਬਾਰਾਂ ਕਿਲੋਮੀਟਰ ਕਰੋਸ ਕੰਟਰੀ ਚੌਦਾਂ ਕਿਲੋਮੀਟਰ ਕਰੋਸ ਕੰਟਰੀ ਔਰ ਸਭ ਤੋਂ ਬੜਾ ਟੀਚਾ ਸੱਠ ਕਿਲੋਮੀਟਰ ਕਮਾਂਡੋ ਚੈਂਲੇਜ ਦਾ ਸੀ ਜੋ ਮੈਂ ਪੂਰਾ ਕੀਤਾ